ਖੇਡਾਂ ਇੱਕ ਵਿਅਕਤੀ ਲਈ ਮਨੋਰੰਜਨ ਅਤੇ ਤਣਾਅ ਤੋਂ ਰਾਹਤ ਦੇ ਸਾਧਨ ਵਜੋਂ ਬਹੁਤ ਹੀ ਵਧੀਆ ਕੰਮ ਕਰਦੀਆਂ ਹਨ ਖੇਡਾਂ ਜਿੰਦਗੀ ਦਾ ਇੱਕ ਮਹੱਤਵਪੂਰਨ ਅੰਗ ਹਨ ਖੇਡਾਂ ਵਿਅਕਤੀ ਦੀ ਜ਼ਿੰਦਗੀ ਲਈ ਬਹੁਤ ਹੀ ਜ਼ਰੂਰੀ ਹਨ ਖੇਡਾਂ ਖੇਡਣ ਦੇ ਨਾਲ ਨਾਲ ਇਹ ਇੱਕ ਮਨੋਰੰਜਨ ਅਤੇ ਰਾਹਤ ਦਾ ਵੀ ਸਾਧਨ ਹਨ ਖੇਡਾਂ ਸਾਡਾ ਮਨੋਰੰਜਨ ਵੀ ਕਰਦੀਆਂ ਹਨ ਜਿਵੇਂ ਕਿ ਅਸੀਂ ਕੋਈ ਖੇਡ ਖੇਡਦੇ ਹਾਂ ਜਿਵੇਂ ਕਿ ਖੋ ਖੋ ਹੀ ਲਾ ਲਓ ਖੋ ਖੋ ਵੀ ਇੱਕ ਖੇਡ ਹੀ ਹੈ ਜਦੋਂ ਅਸੀਂ ਖੋ ਖੋ ਖੇਡਦੇ ਹਾਂ ਤਾਂ ਕਈ ਪੰਜ ਸੱਤ ਜਣੀਆਂ ਰਲ ਕੇ ਖੇਡਦੀਆਂ ਹਨ ਹੱਸਦੀਆਂ ਖੇਡਦੀਆਂ ਹਨ ਗੱਪਾਂ ਮਾਰਦੀਆਂ ਹਨ ਇਹ ਸਾਡੇ ਮਨੋਰੰਜਨ ਦਾ ਸਾਧਨ ਬਣ ਜਾਂਦੀਆਂ ਹਨ ਇਹ ਸਾਨੂੰ ਕਈ ਬਿਮਾਰੀਆਂ ਤੋਂ ਰਾਹਤ ਦਵਾਉਂਦੀਆਂ ਹਨ ਖੇਡਾਂ ਸਾਡੇ ਜ਼ਿੰਦਗੀ ਦਾ ਬੜਾ ਮਹੱਤਵਪੂਰਨ ਅੰਗ ਹਨ ਖੇਡਾਂ ਕਰਨ ਨਾਲ ਸਾਡਾ ਤਣਾਅ ਵੀ ਬਹੁਤ ਘੱਟ ਜਾਂਦਾ ਹੈ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਤਾਜ਼ੀ ਹਵਾ ਮਿਲਦੀ ਹੈ ਖੇਡਾਂ ਖੇਡਣ ਨਾਲ ਬੰਦਾ ਤੰਦਰੁਸਤ ਰਹਿੰਦਾ ਹੈ